ਭੰਗੜਾ ਇੱਕ ਅਜਿਹਾ ਨਾਚ ਦਾ ਦੌਰ ਹੈ ਜਿਹੜਾ ਕਿ ਮਸ਼ਹੂਰ ਹੈ ਆਪਣੇ ਜੋਸ਼ ਲਈ ਭੰਗੜਾ ਐਰੋਬਿਕਸ ਇੱਕ ਅਜਿਹਾ ਕਸਰਤ ਹੈ ਜਿਹੜੀ ਕਿ ਕਈ ਤੌਰ 'ਤੇ ਹੁੰਦੇ ਹਨ ਜਿਵੇਂ ਕਿ ਇਹ ਇੱਕ ਉੱਚ ਤੀਬਰਤਾ ਕਾਰਡੀਓ ਵਰਕਆਊਟ ਹੈ ਭੰਗੜਾ ਇੱਕ ਖ਼ਾਸ ਚੀਜ਼ ਪਹਿਲੇ ਲੋਕ ਕਰਦੇ ਹਨ ਖ਼ਾਸ ਤੌਰ ਉੱਤੇ ਆਪਣਾ ਵਜ਼ਨ ਘਟਾਉਣ ਲਈ ਦੂਸਰਾ ਇਹਦਾ ਫ਼ਾਇਦਾ ਇਹ ਹੈ ਕੀ ਇਹ ਤਣਾਅ ਤੋਂ ਰਾਹਤ ਦਿੰਦੀ ਹੈ ਅਤੇ ਮਾਨਸਿਕ ਤੰਦਰੁਸਤੀ ਪ੍ਰਾਪਤ ਕਰਵਾਉਂਦਾ ਹੈ ਇਹ ਸਾਡਾ ਤਾਲਮੇਲ ਅਤੇ ਸੰਤੁਲਨ ਵਧਾਉਂਦਾ ਹੈ ਕਿਉਂਕਿ ਭੰਗੜਾ ਕਾਫ਼ੀ ਲੋਕਾਂ ਦੇ ਨਾਲ ਕੀਤਾ ਜਾਂਦਾ ਹੈ ਅਤੇ ਇਹ ਕਰਨ ਲਈ ਤਾਲਮੇਲ ਹੋਣਾ ਬਹੁਤ ਹੀ ਜ਼ਰੂਰੀ ਹੈ ਰਵਾਇਤੀ ਭੰਗੜਾ ਪੰਜਾਬੀ ਸੰਗੀਤ ਜਿਹੜਾ ਹੈ ਉਹ ਕਸਰਤ ਨੂੰ ਹੋਰ ਦਿਲਚਲਸ ਦਿਲਚਸਪ ਬਣਾਉਂਦਾ ਹੈ ਕਿਉਂਕੀ ਉਹਦੀ ਊਰਜਾਵਾਂ ਚਾਲਨ ਅਪਬੀਟ ਗਤੀ ਜਿਹੜਾ ਕਿ ਬੰਦੇ ਨੂੰ ਪ੍ਰੋਤਸਾਹਨ ਦਿੰਦਾ ਹੈ ਆਪਣੇ ਸਰੀਰ ਨੂੰ ਹਿਲਾਉਣ ਲਈ ਅਤੇ ਇੱਕ ਖੁਸ਼ ਮੂੜ ਬਣਾਉਣ ਲਈ ਜਿਹੜਾ ਕਿ ਉਹਨਾਂ ਧਿਆਨ ਹਟਾਉਂਦਾ ਹੈ ਮੋਟਾਪੇ ਤੋਂ ਅਤੇ ਕਸਰਤ ਨੂੰ ਮਹਿਸੂਸ ਕਰਨਾ ਨੱਚਣ ਲਈ ਹੋਰ ਅਤੇ ਗਾਣਾ ਸੁਣਨ ਲਈ ਘੱਟ